ਮੈਂ ਰਾਜਕੁਮਾਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਜਿਵੇਂ ਕਿ ਅੱਜ ਸਾਈਕਲ ਬਾਰੇ ਦੱਸਿਆ ਗਿਆ ਹੈ ਕਿ ਸਾਈਕਲ ਦੇ ਕੀ ਫ਼ਾਇਦੇ ਹਨ ਅਤੇ ਕੀ ਨੁਕਸਾਨ ਹਨ ਸਭ ਤੋਂ ਪਹਿਲਾਂ ਸਾਈਕਲ ਦੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ ਕਿ ਨਹੀਂ ਸਾਈਕਲ ਦੀ ਵਰਤੋਂ ਕਰਨੀ ਸਿਹਤ ਲਈ ਸਭ ਤੋਂ ਲਾਭਦਾਇਕ ਹੈ ਜਿਵੇਂ ਕਿ ਅਸੀਂ ਹਜ਼ਾਰਾਂ ਕਿਲੋਮੀਟਰ ਸਾਈਕਲ 'ਤੇ ਸਫ਼ਰ ਕਰਦੇ ਹਾਂ ਤਾਂ ਸਾਨੂੰ ਸਾਈਕਲ ਵਿੱਚ ਪੈਟਰੋਲ ਜਾਂ ਕਿਸੇ ਵੀ ਹੋਰ ਚੀਜ਼ ਦੀ ਲੋੜ ਨਹੀਂ ਪੈਂਦੀ ਜਿਵੇਂ ਸਾਈਕਲ ਚਲਾਉਣ ਵੇਲੇ ਸਾਨੂੰ ਆਪਣੇ ਕੋਲ ਡਰਾਵਰਿੰਗ ਲਾਸੈਂਸ ਦੀ ਲੋੜ ਨਹੀਂ ਜਾਂ ਕਿਸੇ ਹੋਰ ਕਾਗਜ਼ ਦੀ ਵੀ ਜ਼ਰੂਰਤ ਨਹੀਂ ਹੈ ਜਿਵੇਂ ਕਿ ਅਸੀਂ ਇੱਕ ਆਧਾਰ ਕਾਰਡ ਆਪਣਾ ਪਹਿਚਾਣ ਪੱਤਰ ਵੋਟਰ ਕਾਰਡ ਆਪਣੀ ਜੇਬ ਵਿੱਚ ਰੱਖ ਸਕਦੇ ਹਾਂ ਤਾਂ ਕਿ ਕਿਸੇ ਸਮੇਂ ਕੋਈ ਸਾਨੂੰ ਸਾਡੀ ਪਹਿਚਾਣ ਬਾਰੇ ਪੁੱਛ ਲਵੇ ਤਾਂ ਉਹ ਦਸਤਾਵੇਜ਼ ਵਿਖਾ ਕੇ ਅਸੀਂ ਆਪਣੀ ਪਹਿਚਾਣ ਉਸਨੂੰ ਸਾਬਿਤ ਕਰ ਸਕੀਏ ਜੇਕਰ ਅੱਜ ਦੇ ਯੁੱਗ ਵਿੱਚ ਚੱਲੀਏ ਤਾਂ ਇਲੈਕਟਰੀਕਲ ਸਕੂਟੀ ਜਾਂ ਇਲੈਕਟੀਕਲ ਸਾਈਕਲ ਵੀ ਆ ਗਏ ਹਨ ਪਰ ਆਉਣ ਵਾਲੇ ਸਮੇਂ ਵਿੱਚ ਜਿਵੇਂ ਕਿ ਅਸੀਂ ਇਲੈਕਟੀਕਲ ਸਾਈਕਲ ਜਾਂ ਇਲੈਕਟੀਕਲ ਸਕੂਟੀ ਦਾ ਇਸਤੇਮਾਲ ਕਰਦੇ ਹਾਂ ਤਾਂ ਉਸ ਵਿੱਚ ਸਾਨੂੰ ਸਭ ਤੋਂ ਪਹਿਲਾਂ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਪੈਂਦੀ ਹੈ ਉਸ ਲਈ ਸਾਨੂੰ ਕਈ ਦਫਤਰਾਂ ਅਤੇ ਕਈ ਜਗ੍ਹਾ ਜਾ ਕੇ ਧੱਕੇ ਖਾਣੇ ਪੈਂਦੇ ਹਨ ਫਿਰ ਜਾ ਕੇ ਸਾਡਾ ਡਰਾਈਵਿੰਗ ਲਾਇਸੈਂਸ ਬਣਦਾ ਹੈ ਜੇਕਰ ਇੱਕ ਪਾਸੇ ਵੇਖੀਏ ਤਾਂ ਸਾਨੂੰ ਸਾਈਕਲ 'ਤੇ ਕਿਸੇ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਨਹੀਂ ਪੈਂਦੀ ਔਰ ਪਲੱਸ ਅਗਰ ਜੇਕਰ ਅਸੀਂ ਕਿਸੇ ਦੂਰ ਜਗ੍ਹਾ ਇੱਕ ਹਜ਼ਾਰ ਕਿਲੋਮੀਟਰ ਜਾਂ ਸੌ ਕਿਲੋਮੀਟਰ ਦੀ ਹੱਦ ਵਿੱਚ ਜਾਣਾ ਹੋਵੇ ਤਾਂ ਗੱਡੀ 'ਤੇ ਜਾਂਦੇ ਹਾਂ ਤਾਂ ਜੇਕਰ ਰਸਤੇ ਵਿੱਚ ਕਈ ਵਾਰ ਟੋਲ ਪਲਾਜਾ 'ਤੇ ਸਾਨੂੰ ਉਸਦਾ ਟੋਲ ਕਟਵਾਉਣਾ ਪੈਂਦਾ ਹੈ ਜੋ ਕਿ ਕਾਫ਼ੀ ਪੈਸੇ ਲੱਗਦੇ ਹਨ ਜੇਕਰ ਅਸੀਂ ਸਾਈਕਲ 'ਤੇ ਜਾਂਦੇ ਹਾਂ ਤਾਂ ਸਾਨੂੰ ਉਹ ਟੋਲ ਵੀ ਬਚਦਾ ਹੈ ਫਿਰ ਸਾਈਕਲ ਚਲਾਉਣ 'ਤੇ ਸਾਨੂੰ ਕਾਫ਼ੀ ਸਕੂਨ ਮਿਲਦਾ ਹੈ ਉਸ ਦੇ ਨਾਲ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਕੋਈ ਬਿਮਾਰੀ ਨਹੀਂ ਲੱਗਦੀ ਸਾਈਕਲ ਦੇ ਬਹੁਤ ਜ਼ਿਆਦਾ ਫ਼ਾਇਦੇ ਹਨ